ਚੌਵੀ ਮਈ ਦੋ ਹਜ਼ਾਰ ਉੱਨੀ ਅਗਸਤ ਦੋ ਹਜ਼ਾਰ ਬਾਰ੍ਹਾਂ ਅਠਾਰ੍ਹਾਂ ਅਪ੍ਰੈਲ ਉੱਨੀ ਸੌ ਅਨਾਸੀ ਦੱਸ ਨਵੰਬਰ ਉੱਨੀ ਸੌ ਇਕਿਆਸੀ ਇੱਕ ਜਨਵਰੀ ਦੋ ਹਜ਼ਾਰ ਚੌਵੀ